ਹਾਂਜੀ ਜਿਸ ਤਰ੍ਹਾਂ ਮੈਂ ਥੋੜ੍ਹੇ ਦਿਨ ਲਈ ਬਾਹਰ ਜਾਂਦੀ ਹਾਂ ਆਪਣੇ ਪੌਦਿਆਂ ਲਈ ਦੇਖਭਾਲ ਵਾਸਤੇ ਉਹਨਾਂ ਦੀ ਵਧੀਆ ਰਹਿਣ ਕੋਈ ਉਹਨਾਂ ਨੂੰ ਸੁੱਕਣ ਨਾ ਜਾਂ ਕਿਸ ਤਰ੍ਹਾਂ ਵੀ ਆ ਉਹਨਾਂ ਦੀ ਮੈਂ ਪਹਿਲਾਂ ਗੋਡੀ ਕਰਦੀ ਹਾਂ ਉਹਨਾਂ ਨੂੰ ਖਾਦ ਰੂੜੀ ਜੋ ਵੀ ਪਾਣਾ ਹੋਵੇ ਉਹ ਪਾ ਕੇ ਫਿਰ ਮੈਂ ਉਹਨਾਂ ਨੂੰ ਪਾਣੀ ਵੀ ਦੇ ਕੇ ਜਾਂਦੀ ਹਾਂ ਜੇ ਜਿਸ ਤਰ੍ਹਾਂ ਮੈਂ ਜ਼ਿਆਦਾ ਪਾਣੀ ਦੇ ਲੈਂਦੀ ਜੇ ਮੈਨੂੰ ਦੋ ਦਿਨ ਤੋਂ ਵੱਧ ਵੀ ਟਾਈਮ ਲੱਗਣਾ ਹੋਵੇ ਫਿਰ ਮੈਂ ਥੋੜ੍ਹੀਆਂ ਰੱਸੀਆਂ ਲੈ ਕੇ ਉਹ ਗਮਲਿਆਂ 'ਚ ਰੱਖ ਕੇ ਗਮਲਿਆਂ ਨੂੰ ਪਾਣੀ ਨਾਲ ਭਰ ਦਿੰਦੀ ਹਾਂ ਕਿ ਉਹ ਜਿਹੜੀਆਂ ਰੱਸੀਆਂ ਨੇ ਉਹ ਪਾਣੀ ਚੂਸ ਲੈਂਦੀਆਂ ਨੇ ਅਤੇ ਉਹਨਾਂ ਦੀ ਸਲਾਬ ਜਿਹੜੀ ਆ ਉਹ ਰਹਿੰਦੀ ਆ ਅਤੇ ਪੌਦਿਆਂ ਨੂੰ ਇਸ ਤਰ੍ਹਾਂ ਪਾਣੀ ਦੀ ਤਰਾਸ ਜਿਹੜੀ ਮਿਲਦੀ ਰਹਿੰਦੀ ਆ ਅਤੇ ਉਹ ਹਰੇ ਰਹਿੰਦੇ ਆ ਅਤੇ ਜਿਸ ਤਰ੍ਹਾਂ ਹੁਣ ਮੈਂ ਆਪਣੇ ਉੱਤੇ ਧੁੱਪ ਤੋਂ ਬਚਾਉਣ ਵਾਸਤੇ ਤਾਂ ਨੈੱਟ ਦੀ ਵੀ ਕਰਕੇ ਜਾਂਦੀ ਹਾਂ ਜਾਂ ਉਹਨਾਂ ਨੂੰ ਜਦੋਂ ਮੈਂ ਕਈ ਵਾਰੀ ਤਾਂ ਉਹਨਾਂ ਨੂੰ ਨ ਉਹਦੇ ਸ਼ੈੱਡ ਥੱਲੇ ਵੀ ਰੱਖ ਕੇ ਜਾਂਦੀ ਹਾਂ ਕਿ ਜਿੱਥੇ ਉਹਨਾਂ ਨੂੰ ਥੋੜ੍ਹੀ ਧੁੱਪ ਥੋੜ੍ਹਾ ਟਾਈਮ ਧੁੱਪ ਪੈਂਦੀ ਹੈ ਬਾਅਦ 'ਚ ਛਾਂ ਆ ਜਾਂਦੀ ਆ ਕਿ ਉਹਨਾਂ ਨੂੰ ਜ਼ਿਆਦਾ ਧੁੱਪ ਵੀ ਨਹੀਂ ਪੈਂਦੀ ਅਤੇ ਜ਼ਿਆਦਾ ਛਾਂ ਵੀ ਨਹੀਂ ਪੈਂਦੀ ਇਸ ਤਰ੍ਹਾਂ ਉਹ ਸਹੀ ਰਹਿੰਦੀ ਨੇ ਅਤੇ ਉੱਦਾਂ ਜ਼ਿਆਦਾਤਰ ਤਾਂ ਮੈਂ ਖੁਦ ਹੀ ਦੇਖਭਾਲ ਕਰਦੀ ਹਾਂ ਪੌ ਇਹਨਾਂ ਦੀ ਪੌਦਿਆਂ ਦੀ ਪਰ ਮੈਂ ਮਾਲੀ ਵੀ ਰੱਖਿਆ ਹੋਇਆ ਵਾ ਉਹ ਵੀ ਨਾਲ ਦੇਖਭਾਲ ਕਰਦਾ ਵਾ ਅਤੇ ਇਹਨਾਂ ਨੂੰ ਜਦੋਂ ਸਮੇਂ ਸਿਰ ਦਵਾਈ ਖਾਦ ਰੂੜੀ ਜੋ ਵੀ ਚਾਹੀਦਾ ਹੋਵੇ ਗੋਡੀ ਕਰਨੀ ਹੋਵੇ ਉਹ ਮਾਲੀ ਵੀ ਨਾਲ ਕਰਦਾ ਵਾ ਕਿ ਮੈਂ ਮਾਲੀ ਵੀ ਰੱਖਿਆ ਹੋਇਆ ਵਾ